ਪੰਜਾਬੀਆਂ ਨੂੰ ਖਾਣ ਪੀਣ ਦੇ ਸ਼ੌਕੀਨ ਕਿਹਾ ਜਾਂਦਾ ਖਾਣ ਪੀਣ ਤੋਂ ਬਿਨਾਂ ਕੋਈ ਜ਼ਿੰਦਗੀ ਜ਼ਿੰਦਗੀ ਓ ਈ ਨਹੀਂ ਲੱਗਦੀ ਹੈਗੀ ਮੈਨੂੰ ਸਭ ਤੋਂ ਵਧੀਆ ਸਰਦੀਆਂ ਵਿੱਚ ਆਪਣਾ ਪੰਜਾਬ ਦਾ ਸਭ ਤੋਂ ਫੇਮਸ ਖਾਣਾ ਲੱਗਦਾ ਸਾਗ ਅਤੇ ਮੱਕੀ ਦੀ ਰੋਟੀ ਇਹ ਮੈਨੂੰ ਕਾਫ਼ੀ ਫਲੇਵਰਫੁੱਲ ਜਿਹਾ ਫੂਡ ਲੱਗਦਾ ਅਤੇ ਇਹਦੇ ਨਾਲ਼ ਮੇਰੀ ਸਾਰੀ ਫੁੱਲਫੀਲਿੰਗ ਵੀ ਉਹ ਹੋ ਜਾਂਦੀ ਹੈ ਵੀ ਮੈਨੂੰ ਬਹੁਤ ਵਧੀਆ ਲੱਗਦਾ ਇਹਨੂੰ ਖਾ ਕੇ ਅਤੇ ਜਿਹੜਾ ਸਾਗ ਹੈ ਇੱਕ ਮੈਨੂੰ ਕਾਫ਼ੀ ਫਰੈੱਸ਼ ਜਿਹਾ ਵੀ ਲੱਗਦਾ ਇਹ ਖਾ ਕੇ ਮੈਨੂੰ ਨਾ ਬੜਾ ਵਧੀਆ ਤਾਜ਼ਾ ਤਾਜ਼ਾ ਮਹਿਸੂਸ ਹੁੰਦਾ ਕਿਉਂਕਿ ਸਾਗ ਹੈ ਜਿਹੜਾ ਇੱਕ ਵਧੀਆ ਅਸੀਂ ਖੇਤਾਂ ਵਿੱਚੋਂ ਤੋੜ ਕੇ ਲੈ ਕੇ ਆਉਂਦੇ ਹੁੰਦੇ ਹਾਂ ਅਤੇ ਇਹਨਾਂ ਨੂੰ ਨਾਲ਼ ਦੀ ਨਾਲ਼ ਅਸੀਂ ਬਣਾ ਕੇ ਵਿੱਚ ਅਸੀਂ ਦੇਸੀ ਘਿਓ ਪਾ ਕੇ ਇਹਨੂੰ ਐਨ ਵਧੀਆ ਤਰੀਕੇ ਨਾਲ਼ ਖਾਂਦੇ ਹਾਂ ਅਤੇ ਜਿਹੜੀ ਮੱਕੀ ਦੀ ਰੋਟੀ ਹੈ ਇਹ ਨਾ ਸਾਗ ਨੂੰ ਹੋਰ ਵੀ ਐਨ ਚਾਰ ਚੰਨ ਲਾ ਦਿੰਦੀ ਹੈ ਇਹ ਖਾਣਾ ਸਾਨੂੰ ਨਾ ਇੰਨਾ ਕੁ ਜ਼ਿਆਦਾ ਵਧੀਆ ਲੱਗਦਾ ਸਰਦੀਆਂ 'ਚ ਕਿ ਇਹ ਕਿ ਇਹਦੇ ਨਾਲ਼ ਹੀ ਲੱਗਦਾ ਬਸ ਹਾਂ ਇਹਨੇ ਸਾਨੂੰ ਇੰਨੀ ਵਧੀਆ ਜ਼ਿੰਦਗੀ ਦੇਤੀ ਕਾਫ਼ੀ ਤਰ੍ਹਾਂ ਕਾਫ਼ੀ ਲੋਕਾਂ ਨੂੰ ਆਪਣੇ ਆਪਣੇ ਹਿਸਾਬ ਨਾਲ਼ ਸਾਰਾ ਫੂਡ ਪਸੰਦ ਹੁੰਦਾ ਮੈਂ ਹਾਂ ਮੈਨੂੰ ਅਲੱਗ ਤਰੀਕੇ ਦਾ ਭੋਜਨ ਪਸੰਦ ਆ ਜਿਹੜੇ ਹੋਰ ਨੇ ਉਹਨਾਂ ਨੂੰ ਹੋਰ ਤਰੀਕੇ ਦਾ ਭੋਜਨ ਪਸੰਦ ਹੈ